ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਸਟੇਸ਼ਨਰੀ ਤੋਂ ਬੋਲਦੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਚੰਗੀ ਕੁਆਲਿਟੀ ਮਿਲਦੀ ਦੱਸੋ ਤੁਹਾਨੂੰ ਕੀ ਚਾਹੀਦਾ ਜੀ ਸਾਡੀਆਂ ਕਾਪੀਆਂ ਦੀ ਸਟਾਰਟ ਹੋ ਜਾਂਦੀ ਆਂ ਮਤਲਬ ਵੀਹ ਰੁਪਏ ਤੋਂ ਲੈ ਕੇ ਦੋ ਸੌ ਰੁਪਏ ਦੇ ਵਿੱਚ ਵਿੱਚ ਹੈ ਜੀ ਕਾਪੀਆਂ ਜਿਹੜੀ ਮਰਜ਼ੀ ਤੁਸੀਂ ਲਾਈਨਿੰਗ ਵਾਲੀ ਲੈ ਹਾਂਜੀ ਹਾਂਜੀ ਪੈਨਸਲ ਵੀ ਤੁਹਾਨੂੰ ਮਿਲ ਜਾਣੀ ਹੈ ਜੀ ਪੈੱਨ ਵੀ ਮਿਲ ਜਾਣੇ ਵਧੀਆ ਕੁਆਲਟੀ ਪੈੱਨ ਸਾਡੇ ਕੋਲ ਹੈ ਹੀ ਸੈਲੋਗਰੀਪਰ ਦੇ ਹੈਗੇ ਰੈਨੋਡ ਦੇ ਹੈਗੇ ਆਟੋਮੈਕਸ ਦੇ ਹੈਗੇ ਜੀ ਮਤਲਬ ਹਾਂਜੀ ਸਾਰੇ ਵਧੀਆ ਕੁਆਲਿਟੀ ਰੱਖੀ ਹੋਈ ਹੈ ਹਾਂਜੀ ਹਾਂ ਹਾਂ ਹਾਂਜੀ ਹਾਂਜੀ ਹਾਂਜੀ ਰਾਂਜੀ ਕੋਈ ਨਹੀਂ ਤੁਸੀਂ ਮੈਨੂੰ ਦੱਸ ਦਿਓ ਕਿਆ ਕਿਆ ਤੁਹਾਨੂੰ ਚਾਹੀਦਾ ਹਾਂਜੀ ਹਾਂਜੀ ਹਾਂ ਨਹੀਂ ਹਾਂਜੀ ਹਾਂਜੀ ਨਹੀ ਅਸੀਂ ਵਧੀਆ ਸਮਾਨ ਰੱਖਦੇ ਅਸੀਂ ਕਸਟਮਰ ਨੂੰ ਸੈਟਿਸਫਾਈ ਕਰਕੇ ਭੇਜ ਦੇ ਨੇ ਅਸੀਂ ਖਰਾਬ ਚੀਜ਼ ਵੇਚਣ ਲੱਗੋ ਫਿਰ ਤੁਹਾਨੂੰ ਪਤਾ ਹੀ ਆ ਕੋਈ ਲਵੇਗਾ ਨਹੀਂ ਸਾਡੇ ਤੋਂ ਹਾਂਜੀ ਹਾਂਜੀ ਮੈਂ ਕੋਈ ਨਹੀਂ ਤੁਹਾਨੂੰ ਦੱਸ ਦਾਂਗਾ ਜੀ ਤੁਹਾਨੂੰ ਵਟਸਐਪ ਮੈਂ ਕਰ ਦਾਂਗਾ ਫਿਰ ਹਾਂਜੀ ਹਾਂਜੀ ਤੁਸੀਂ ਲਿਸਟ ਭੇਜ ਦਿਓ ਕੋਈ ਨਹੀਂ ਫਿਰ ਸਮਾਨ ਤੁਹਾਡੇ ਆ ਜਾਵੇਗਾ ਜੀ ਤੁਹਾਡੇ ਘਰ ਪੁੱਜ ਜੂਗਾ ਜੀ ਹਾਂਜੀ ਹਾਂਜੀ ਕਲਾਸਮੇਟ ਦੇ ਰਜਿਸਟਰ ਹਾਂਜੀ ਹਾਂਜੀ ਉਹ ਵੀ ਪਏ ਵੇ ਆ ਸਾਡੇ ਕੋਲ ਜੀ

ਹਾਂਜੀ ਹਾਂਜੀ ਕੋਈ ਨਹੀਂ ਤੁਹਾਨੂੰ ਮਾੜਾ ਮੋਟਾ ਡਿਸਕਾਊਂਟ ਵੀ ਅਸੀਂ ਦੇ ਦਾਂਗੇ ਉਹਦੇ 'ਚ ਜਿਹੜਾ ਬਣਦਾ ਜੀ ਟਵੈਂਟੀ ਜਾਂ ਥਰਟੀ ਪ੍ਰਸੈਂਟ ਕੋਈ ਨਹੀਂ ਤੁਹਾਨੂੰ ਜਿੱਦਾਂ ਤੁਸੀਂ ਚਾਹੀਦਾ ਤੁਹਾਨੂੰ ਮਿਲ ਜੂਗੀ ਚੀਜ਼ ਹਾਂਜੀ ਓਕੇ ਠੀਕ ਹੈ ਧੰਨਵਾਦ ਠੀਕ ਹੈ ਓਕੇ